ਹੈਲੋ ਹਾਂਜੀ ਅਨੇਜਾ ਦੁਕਾਨ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਹਾਂਜੀ ਮੈਂ ਨਾ ਓਡਰ ਦੇਣਾ ਸੀਗਾ ਪਹਿਲਾਂ ਵੀ ਤੁਹਾਡੇ ਤੋਂ ਬਹੁਤ ਓਡਰ ਮਤਲਬ ਕਿ ਲਏ ਨੇ ਤੁਹਾਡੇ ਮਤਲਬ ਬਹੁਤ ਵਾਰੀ ਅਸੀਂ ਸਮਾਨ ਖਰੀਦਿਆ ਇੱਥੋਂ ਅਤੇ ਤੁਹਾਡੀ ਜਿਹੜੀ ਕੁਆਲਿਟੀ ਹੈਗੀ ਉਹ ਬਹੁਤ ਵਧੀਆ ਹੈਗੀ ਮਤਲਬ ਮੈਂ ਤਾਂ ਮੈਨੂੰ ਤਾਂ ਬਹੁਤ ਪਸੰਦ ਤੁਹਾਡੀ ਹਰ ਇੱਕ ਚੀਜ਼ ਦੀ ਮਤਲਬ ਖਾਸ ਕਰਕੇ ਹੈ ਨਾ ਜਿਹੜੀ ਤੁਹਾਡੇ ਕੇਕ ਬਣਾਏ ਜਾਂਦੇ ਆ ਮਿਠਾਈਆਂ ਹੋ ਗਈਆਂ ਅਤੇ ਜਿਹੜੀ ਤੁਸੀਂ ਆ ਫਰੂਟ ਕੇਕ ਹੋ ਗਿਆ ਆਪਾਂ ਨਾ ਅਤੇ ਜਿਵੇਂ ਆਹ ਦੂਜੇ ਤੁਸੀਂ ਫਾਸਟ ਫੂਡ ਕਹਿ ਸਕਦੇ ਹੋ ਜਿੰਨੇ ਹੈ ਨਾ ਜਿਵੇਂ ਪਾਸਤਾ ਮੈਗੀ ਬਣਾਉਂਦੇ ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਮਤਲਬ ਵਧੀਆ ਉਹਦੀਆਂ ਹੁੰਦੀਆਂ ਨੇ ਵੀ ਬਹੁਤ ਸਵਾਦ ਹੁੰਦੀਆਂ ਨੇ ਅਤੇ ਸਾਡੇ ਜਿਵੇਂ ਨਾ ਸ਼ਾਮ ਨੂੰ ਇੱਕ ਨਿੱਕਾ ਜਿਹਾ ਪ੍ਰੋਗਰਾਮ ਸੀਗਾ ਜਨਮਦਿਨ ਕਰਕੇ ਅਤੇ ਪ ਲ ਪਿਛਲੀ ਵਾਰੀ ਤਾਂ ਅਸੀਂ ਇੱਥੇ ਹੀ ਮਨਾਇਆ ਸੀਗਾ ਆਪਣੇ ਇੱਥੇ ਹੀ ਅਤੇ ਬਹੁਤ ਵਧੀਆ ਲੱਗਿਆ ਸੀਗਾ ਮਤਲਬ ਕਿ ਹਰ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਮਤਲਬ ਪੂਰੇ ਉਹਨੂੰ ਸਾ ਸਾਜੋ ਸਮਾਨ ਨੂੰ ਲੈ ਕੇ ਪੂਰਾ ਇਹ ਸ਼ਾਨਦਾਰ ਤੁਸੀਂ ਸਜਾਇਆ ਹੋਇਆ ਸੀਗਾ ਖਾਣ ਪੀਣ ਨੂੰ ਲੈ ਕੇ ਪੂਰੀ ਵਧੀਆ ਐਂ ਸਫਾਈ ਨਾਲ ਬਹੁਤ ਹੀ ਮਤਲਬ ਬਹੁਤ ਵਧੀਆ ਰਿਹਾ ਸੀਗਾ ਐਤਕੀ ਅਸੀਂ ਸੋਚਿਆ ਵੀ ਚਲੋ ਘਰੇ ਮਨਾ ਲੈਂਦੇ ਹੈਗੇ ਅਤੇ ਸਾਨੂੰ ਨਾ ਮਤਲਬ ਤੁਹਾਨੂੰ ਮੈਂ ਦ ਦੱਸ ਦਿੰਦੀ ਚਾਰ ਪੰਜ ਚੀਜ਼ਾਂ ਹੀ ਇਹ ਮੰਗਾਉਣੀਆਂ ਸੀਗੀਆਂ ਅਤੇ ਇੱਕ ਤਾਂ ਸਮੋਸੇ ਹੋ ਗਏ ਪੰਦਰਾਂ ਕੁ ਸਮੋਸੇ ਭੇਜ ਦਿਓ ਤੁਸੀਂ ਅਤੇ ਦੋ ਹੋ ਗਈਆਂ ਇਹਦੀਆਂ ਜਿਹੜੀਆਂ ਆਪਣਾ ਕੋਕਾ ਕੋਲਾ ਆਹ ਪੈਪਸੀ ਹੁੰਦੀ ਜਿਹੜੀ ਉਹ ਉਹ ਭੇਜ ਦਿਓ ਅਤੇ ਨਾਲ ਜਿਹੜੇ ਆ ਗਲਾਸ ਹੁੰਦੇ ਨੇ ਆਪਾਂ ਜਿਹੜੇ ਕਹਿੰਦੇ ਹਾਂ ਉਹਨੂੰ ਡਿਸਪੋਜਲ ਜੇ ਕਹਿੰਦੇ ਹਾਂ ਅਤੇ ਉਹ ਭੇਜ ਦਿਓ ਅਤੇ ਬਾਕੀ ਤੁਸੀਂ ਤਿੰਨ ਡੱਬੇ ਮਿਠਾਈ ਦੇ ਭੇਜੋ ਇੱਕ ਚਮਚਮ ਦੇ ਅਤੇ ਇੱਕ ਫਰੋ ਜਿਹੜਾ ਹੁੰਦਾ ਆਹ ਬਰਫੀ ਦਾ ਅਤੇ ਇੱਕ ਜਿਹੜਾ ਪਾਸਤਾ ਇਹਦਾ ਹੁੰਦਾ ਹੈਗਾ ਜਿਹੜਾ ਆਪਾਂ ਕਹਿੰਦੇ ਹਾਂ ਇਹਨੂੰ ਜਿਹੜੀ ਆ ਹੁੰਦੀ ਆ ਕਾਜੂ ਕਤਲੀ ਇਹ ਭੇਜ ਦਿਓ ਅਤੇ ਬਾਕੀ ਜਿਹੜਾ ਤਾਂ ਕੀ ਕਹਿੰਦੇ ਹੁੰਦੇ ਆ ਬਹੁਤ ਵਧੀਆ ਮਤਲਬ ਕਿ ਕ ਹੁੰਦੀ ਹੈ ਕੁਆਲਿਟੀ ਬਸ ਤੁਸੀਂ ਇਹ 'ਚ ਸਾਰੀਆਂ ਚੀਜ਼ਾਂ ਓਡਰ ਕਰ ਦਿਓ ਅਤੇ ਬਾਕੀ ਤੁਹਾਡਾ ਜਿਹੜਾ ਮੈਂ ਬਾਕੀ ਥੋ ਤੁਹਾਡੇ ਉਹ ਵੀ ਚੈੱਕ ਕੀਤਾ ਸੀ ਮੈਨੂੰ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਹੈ ਤੁਸੀਂ ਬਸ ਆਹ ਚਾਰ ਪੰਜ ਆਈਟਮਾਂ ਨੇ ਸਾਨੂੰ ਭੇਜ ਦਿਓ ਟਾਈਮ ਨਾਲ ਅਤੇ ਬਾਕੀ ਚਲੋ ਖਾ ਪੀ ਕੇ ਦੁਬਾਰੇ ਫਿਰ ਦੇਖਦੇ ਹੈਗੇ ਨਾ ਵੀ ਤਾਂ ਕਿ ਕੀ ਉਹ ਹੈਗਾ ਮੈਂ ਮਾਰਕ ਕਰ ਦਊਗੀ ਤੁਹਾਡੀ ਉਹੀ ਜਿਹੜੀ ਕੁਆਲਿਟੀ ਹੈਗੀ ਅਤੇ ਹਾਂਜੀ ਠੀਕ ਹੈ ਚਲੋ ਜੀ ਥੈਂਕ ਯੂ